ਤਕਨਾਲੋਜੀ ਦੀ ਵਰਤੋਂ ਨੇ ਸਾਡੇ ਪੱਧਰ ਨੂੰ ਗੱਲਬਾਤ ਕਰਨ ਦੇ ਪੱਧਰ ਨੂੰ ਬਹੁਤ ਉੱਚਾ ਚੱਕਿਆ ਹੈ ਤਕਨਾਲੋਜੀ ਦੀ ਵਰਤੋਂ ਨਾਲ ਅਸੀਂ ਘੰਟਿਆਂ ਦਾ ਸਫ਼ਰ ਮਿੰਟਾਂ ਵਿੱਚ ਤੈਅ ਕਰ ਜਾਂਦੇ ਹਾਂ ਤਕਨਾਲੋਜੀ ਦੀ ਵਰਤੋਂ ਨਾਲ ਅਸੀਂ ਲੰਮੀ ਦੂਰੀ ਨੂੰ ਕੁਛ ਸਮੇਂ ਵਿੱਚ ਤੈਅ ਕਰ ਜਾਂਦੇ ਹਾਂ ਤਕਨਾਲੋਜੀ ਦੀ ਵਰਤੋਂ ਨਾਲ ਅਸੀਂ ਆਪਣੇ ਦੂਰ ਬੈਠੇ ਪਰਿਵਾਰ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਦੇਖ ਅਤੇ ਸੁਣ ਸਕਦੇ ਹਾਂ ਜਿਸ ਕਾਰਨ ਉਹਨਾਂ ਦੇ ਦੂਰ ਹੋਣ ਦਾ ਸਾਨੂੰ ਅਹਿਸਾਸ ਇਹ ਨਹੀਂ ਹੋਣ ਹੁੰਦਾ ਸ਼ੋਸ਼ਲ ਮੀਡੀਆ ਦੇ ਜਿੱਥੇ ਬਹੁਤ ਸਾਰੇ ਸਕਰਾਤਮਕ ਨਤੀਜੇ ਹਨ ਉੱਥੇ ਨਕਰਾਤਮਕ ਹੋਣੇ ਵੀ ਸੁਭਾਵਿਕ ਹਨ ਨਵੀਂ ਪੀੜ੍ਹੀ ਸ਼ੋਸ਼ਲ ਮੀਡੀਆ ਦੀ ਇੰਨੀ ਆਦੀ ਹੋ ਚੁੱਕੀ ਹੈ ਕਿ ਉਹ ਪਰਿਵਾਰ ਵਿੱਚ ਰਹਿ ਕੇ ਵੀ ਪਰਿਵਾਰ ਤੋਂ ਦੂਰ ਹੁੰਦੀ ਜਾ ਰਹੀ ਹੈ ਰਿਸ਼ਤਿਆਂ ਦੀ ਅਹਿਮੀਅਤ ਨੂੰ ਭੁੱਲਣ ਵਿੱਚ ਸ਼ੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ ਸ਼ੋਸ਼ਲ ਮੀਡੀਆ ਕਾਰਨ ਹੀ ਉਹਨਾਂ ਦੀ ਸਹਿਣਸ਼ੀਲਤਾ ਉਹਨਾਂ ਦੇ ਗੱਲਬਾਤ ਕਰਨ ਦਾ ਤਰੀਕਾ ਤਰੀਕੇ ਦਾ ਮਿਆਰ ਗਿਰਦਾ ਜਾ ਰਿਹਾ ਹੈ ਅਜਿਹੇ ਬਹੁਤ ਸਾਰੇ ਕਾਰਨ ਹਨ ਜਿਸ ਕਾਰਨ ਸ਼ੋਸ਼ਲ ਮੀਡੀਆ ਦੇ ਸਕਾਰਾਤਮਕ ਨਤੀਜ਼ਿਆਂ ਦੀ ਥਾਂ 'ਤੇ ਨਕਾਰਾਤਮਕ ਨਤੀਜ਼ੇ ਜ਼ਿਆਦਾ ਦੇਖਣ ਨੂੰ ਮਿਲਦੇ ਹਨ